ਖਾਣਾ ਬਣਾਉਣਾ ਸਾਡੇ ਜੀਵਨ ਦੀ ਆਮ ਸ਼ੈਲੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਪਰ ਜਦੋਂ ਤੁਸੀਂ ਕਿਤੇ ਵਧੇਰੇ ਗਰੁੱਪ ਜਾਂ ਵਧੇਰੇ ਲੋਕਾਂ ਲਈ ਖਾਣਾ ਬਣਾਉਂਦੇ ਹੋ ਉਹ ਆ ਘਰ ਦੇ ਖਾਣਾ ਬਣਾਉਣ ਨਾਲੋਂ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਇਸ ਦੇ ਵਿੱਚ ਇੱਕ ਤਾਂ ਤੁਹਾਨੂੰ ਉਹਦੀ ਚੀਜ਼ਾਂ ਦੀ ਜਿਹੜੀ ਕੁਆਲਿਟੀ ਹੁੰਦੀ ਆ ਉਹ ਵਧੀਆ ਰੱਖਣੀ ਪੈਂਦੀ ਆ ਅਤੇ ਨੰਬਰ ਦੋ ਉਹਦੀ ਕ ਕਿੰਨਾਂ ਚਾਹੀਦਾ ਤੁਹਾਨੂੰ ਇਹ ਦੇਖਣਾ ਪੈਂਦਾ ਪਹਿਲਾਂ ਤੁਹਾਨੂੰ ਹਲਵਾਈ ਬੁੱਕ ਕਰਨਾ ਪੈਂਦਾ ਹਲਵਾਈ ਬੁੱਕ ਕਰਨ ਲਈ ਤੁਹਾਨੂੰ ਉਹ ਦੇਖਣਾ ਹਲਵਾਈ ਵਧੀਆ ਦੇਖਣਾ ਪੈਂਦਾ ਉਹਦੀ ਦ ਦੇਖਣਾ ਪੈਂਦਾ ਵੀ ਸਮਾਨ ਕਿਵੇਂ ਬਣਾਉਂਦਾ ਉਹਦੇ ਲਈ ਫਿਰ ਤੁਹਾਨੂੰ ਹੋਰ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਕਿ ਮੰਡੀ ਤੋਂ ਸਮਾਨ ਲੈ ਕੇ ਆਉਣਾ ਸਬਜ਼ੀ ਹਰੀਆਂ ਸਬਜ਼ੀਆਂ ਅਤੇ ਕਰਿਆਨੇ ਸਮਾਨ ਲੈ ਕੇ ਆਉਣਾ ਇਹਦੇ ਵਿੱਚ ਵੀ ਤੁਹਾਨੂੰ ਬੰਦਿਆਂ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਕਿ ਮੇਰੀ ਭੈਣ ਦੇ ਵਿਆਹ ਦੇ ਵਿੱਚ ਮੈਂ ਆਪਣਾ ਕੰਮ ਵੰਡ ਲਿਆ ਸੀਗਾ ਮੈਂ ਆਪਣੇ ਪ ਕੰਮ ਵੰਡਿਆ ਹੋਇਆ ਮੈਂ ਆਪਣੇ ਇੱਕ ਯਾਰ ਦੋਸਤ ਨੂੰ ਮਿੱਤਰ ਨੂੰ ਮੰਡੀ ਤੋਂ ਸਮਾਨ ਲਿਆਉਣ ਲਈ ਕਿਹਾ ਅਤੇ ਦੂਜੇ ਨੂੰ ਕਿਹਾ ਵੀ ਤੂੰ ਕਰਿਆਨੇ ਦਾ ਸਮਾਨ ਲੈ ਕੇ ਆਉਣਾ ਜਿਹੜਾ ਮੇਰਾ ਇੱਕ ਮਿੱਤਰ ਮੇਰਾ ਮੰਡੀ ਤੋਂ ਜਾ ਕੇ ਸਵੇਰੇ ਸਾਜਰੇ ਜਾ ਕੇ ਜਿਵੇਂ ਹਰੀਆਂ ਸਬਜ਼ੀਆਂ ਪਾਲਕ ਮੇਥੇ ਧਨੀਆ ਗੋਭੀ ਆਲੂ ਪਿਆਜ ਟਮਾਟਰ ਮ ਮਟਰ ਇਹ ਮਸ਼ਰੂਮ ਅਤੇ ਹੋਰ ਫਰੂਟ ਇਹ ਸਾਰਾ ਕੁਛ ਉਹ ਆਪ ਲੈ ਕੇ ਆਇਆ ਅਤੇ ਦੂਜਾ ਯਾਰ ਮੇਰਾ ਕਰਿਆਨੇ ਦਾ ਸਮਾਨ ਲੈ ਕੇ ਆਇਆ ਜਿਹਦੇ ਵਿੱਚ ਉਸਨੂੰ ਆਪਣਾ ਜਿਵੇਂ ਰਿਫਾਇੰਡ ਹੋਇਆ ਦੇਸੀ ਘੀ ਹੋਇਆ ਚੀਨੀ ਹੋਈ ਮੈਦਾ ਹੋਇਆ ਮੱਖਣ ਹੋਇਆ ਕਰੀਮ ਹੋਈ ਦਹੀਂ ਹੋਇਆ ਪ ਦੁੱਧ ਹੋਇਆ ਅਤੇ ਦਾਲਾਂ ਸਬਜ਼ੀਆਂ ਲੂਣ ਮਿਰਚ ਮਸਾਲੇ ਆਦਿ ਸਮਾਨ ਲਿਆਉਣਾ ਪਿਆ ਅਤੇ ਅਤੇ ਫਿਰ ਮੈਂ ਆਪਣੀ ਜ਼ਿੰਮੇਵਾਰੀ ਨੂੰ ਹੋਰ ਜ਼ਿਆਦਾ ਤਰੀਕੇ ਨਾਲ ਨਿਭਾਉਣ ਲਈ ਇੱਕ ਦੋ ਬੰਦਿਆਂ ਦੀ ਹੋਰ ਹੈਲਪ ਲਈ ਜਿਹਨਾਂ ਦੇ ਵਿੱਚ ਮੈਨੂੰ ਉਹਨਾਂ ਨੇ ਟੈਂਟ ਲਾਉਣ ਲਈ ਬੰਦੇ ਦਾ ਇੰਤਜ਼ਾਮ ਕਰਕੇ ਦਿੱਤਾ ਸਲੰਡਰ ਦਾ ਇੰਤਜ਼ਾਮ ਕਰਕੇ ਦਿੱਤਾ ਅਤੇ ਅਸੀਂ ਰਲ ਮਿਲ ਕੇ ਸਾਰਾ ਇਹ ਫੰਕਸ਼ਨ ਸਿਰੇ ਚੜ੍ਹਾਇਆ